ਹੈਲੋ ਹਾਂਜੀ ਆਪਣੇ ਬਿੱਗ ਕਲੋਥ ਹਾਊਸ ਤੋਂ ਬੋਲਦੇ ਭਾਅ ਜੀ ਭਾਅ ਜੀ ਆਪਾਂ ਨੂੰ ਕੁਛ ਗਰਮ ਕੱਪੜੇ ਚਾਹੀਦੇ ਸੀ ਸਰਦੀ ਵਾਸਤੇ ਅਤੇ ਆਪਣੇ ਕੋਲੋਂ ਕਿਸ ਤਰ੍ਹਾਂ ਦੇ ਕੱਪੜੇ ਮਿਲ ਜਾਣਗੇ ਜੀ ਹਾਂਜੀ ਹਾਂਜੀ ਅਤੇ ਆਪਣੇ ਕੋਲੋਂ ਬੱਚਿਆਂ ਦੇ ਮਿਲ ਜਾਣਗੇ ਹਾਂਜੀ ਅਤੇ ਬ ਆਪਣੇ ਬਜ਼ੁਰਗਾਂ ਨੂੰ ਮਿਲ ਜਾਣਗੇ ਜੀ ਹਾਂਜੀ ਅਤੇ ਆਪਣੇ ਕੋਲ ਸਲੈਕਸ ਵਗੈਰਾ ਹਾਂਜੀ ਹਾਂ ਹਾਂਜੀ ਅਤੇ ਆਪਣੇ ਕੋਲੋਂ ਭਾਅ ਜੀ ਮਾਲ ਕ ਕਿੱਥੋਂ ਦਾ ਜੀ ਇੱਥੇ ਲੋਕਲ ਹੀ ਹੈ ਜੀ ਕਿ ਬਾਹਰੋਂ ਮੰਗਵਾਉਂਦੇ ਹੋ ਤੁਸੀਂ ਅੱਛਾ ਜੀ ਹਾਂਜੀ ਕਿਹੜੀ ਕੰਪਨੀਆਂ ਦਾ ਮਾਲ ਰੱਖਿਆ ਜੀ ਆਪਾਂ ਹਾਂਜੀ ਹਾਂਜੀ ਅੱਛਾ ਜੀ ਅਤੇ ਲੇਡੀਜ਼ ਦੇ ਇਹਨਾਂ ਦੇ ਕੀ ਪ੍ਰਾਈਜ਼ ਚੱਲਦਾ ਜੀ ਹਾਂਜੀ ਹਾਂਜੀ ਹਾਂਜੀ ਜੀ

ਹਾਂਜੀ ਹਾਂਜੀ ਹਾਂਜੀ ਅਤੇ ਆਪਣੇ ਲੇਡੀਜ਼ ਕੈਪ ਵਗੈਰਾ ਹਾਂਜੀ ਹਾਂਜੀ ਅ ਹਾਂਜੀ ਹਾਂਜੀ ਹਾਂਜੀ ਅਤੇ ਆਪਣੇ ਲੇ ਲੇਡੀਜ਼ ਕੈ ਹਾਂਜੀ ਹਾਂਜੀ ਹਾਂਜੀ ਅਤੇ ਆਪਣੇ ਲੇਡੀਜ਼ ਕੈਪ ਮਿਲ ਜਾਵੇਗੀ ਹਾਂਜੀ ਅਤੇ ਇਹਨਾਂ ਦੀ ਕਿਸ ਤਰ੍ਹਾਂ ਪ੍ਰਾਈਜ਼ ਹੈ ਜੀ ਲੇਡੀਜ਼ ਕੈਪ ਦੇ

ਹਾਂਜੀ ਹਾਂਜੀ ਹਾਂਜੀ ਅਤੇ ਗਲਬਸ ਹਾਂ ਹਾਂਜੀ ਹਾਂਜੀ

ਗਲੋ ਗਲਬਸ ਦੀ ਕੁਆਲਿਟੀ ਕਿਹੇ ਜਿਹੀ ਹੈ ਜੀ ਅੱਛਾ ਜੀ ਮਤਲਬ ਲੇਡੀਜ਼ ਐਂਡ ਜੈਂਟਸ ਦੋਨੇ ਯੂਜ਼ ਕਰ ਸਕਦੇ ਹੈ ਜੀ ਹਾਂਜੀ ਹਾਂਜੀ ਅਤੇ ਆਪਣੇ ਬੱਚਿਆਂ ਦੇ ਵੀ ਹੈਗੇ ਹੈ ਜੀ ਗਲਬਸ ਹਾਂਜੀ ਜੀ ਹਾਂਜੀ ਜੀ ਆਪਣਾ ਅਡਰੈਸ ਕੀ ਭਾਅ ਜੀ

ਠੀਕ ਹੈ ਭਾਅ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ